ਸਾਡੇ ਖੇਤਰ ਵਿੱਚ ਕੁਝ ਅਜਿਹੀਆਂ ਕੰਪਨੀਆਂ ਹਨ ਜੋ ਕਿ ਖੇਡਾਂ ਨੂੰ ਉਤਸ਼ਾਹ ਕਰਨ ਲਈ ਖਿਡਾਰੀਆਂ ਨੂੰ ਸਹਾਇਤਾ ਕਰਦੀਆਂ ਹਨ ਜੋ ਉਹਨਾਂ ਨੂੰ ਰਾਜ ਪੱਧਰੀ ਰਾਸ਼ਟਰੀ ਪੱਧਰੀ ਅਤੇ ਅੰਤਰਰਾਸ਼ਟਰੀ ਪੱਧਰ ਵਿੱਚ ਖੇਡਣ ਲਈ ਉਤਸ਼ਾਹ ਭਰਦੀਆਂ ਰਹਿੰਦੀਆਂ ਹਨ ਜਿਵੇਂ ਕਿ ਜੀਓ ਰਿਲਾਇੰਸ ਵਰਗੀਆਂ ਕੰਪਨੀਆਂ ਇਹ ਉਹਨਾਂ ਨੂੰ ਅਲੱਗ ਅਲੱਗ ਪੱਧਰ 'ਤੇ ਕੰਪਟੀਸ਼ਨ ਵਿੱਚ ਹਿੱਸਾ ਦਿਵਾਉਣ ਲਈ ਪੈਸੇ ਦਿੰਦੇ ਹਨ ਅਤੇ ਹੋਰ ਵੀ ਉਤਸ਼ਾਹ ਭਰਦੇ ਹਨ ਉਹਨਾਂ ਦੀ ਤਿਆਰੀ ਲਈ ਉਹਨਾਂ ਨੂੰ ਵੱਖ ਵੱਖ ਸਮਾਨ ਮੁਹੱਈਆ ਕਰਵਾਉਂਦੇ ਹਨ ਜੋ ਚੀਜ਼ਾਂ ਕਈ ਵਾਰ ਸਰਕਾਰ ਨਹੀਂ ਕਰ ਸਕਦੀ ਉਹ ਇਹ ਵੱਡੀਆਂ ਕੰਪਨੀਆਂ ਉਹਨਾਂ ਨੂੰ ਮੁਹਈਆ ਕਰਵਾ ਕੇ ਉਹਨਾਂ ਵਿੱਚ ਉਤਸ਼ਾਹ ਭਰਦੇ ਹਨ ਜਿਸ ਨਾਲ ਖਿਡਾਰੀ ਚੰਗਾ ਖੇਡਦੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ